ਜੀ ਹਾਂ ਮੇਰੇ ਕੋਲ ਮਾਈਕਰੋਵੇਵ ਉਵਨ ਹੈ ਅਤੇ ਉਸਨੂੰ ਅਸੀਂ ਉਸਦੇ ਵਿੱਚ ਅਸੀਂ ਕੁਝ ਵੀ ਖਾਣਾ ਗਰਮ ਕਰ ਸਕਦੇ ਹਾਂ ਅਤੇ ਤਰ੍ਹਾਂ ਤਰ੍ਹਾਂ ਦੀ ਨਈ ਨਵਾਂ ਨਵਾਂ ਪਕਵਾਨ ਬਣਾ ਸਕਦੇ ਹਾਂ ਜਿਵੇਂ ਅਸੀਂ ਕੇਕ ਬਣਾ ਸਕਦੇ ਹਾਂ ਕੂਕੀਜ਼ ਬਣਾ ਸਕਦੇ ਹਾਂ ਅਤੇ ਹੋਰ ਵੀ ਉਹ ਉਸਦੇ ਵਿੱਚ ਅਸੀਂ ਸਾਨੂੰ ਕੁਛ ਨਹੀਂ ਕਰਨਾ ਪੈਂਦਾ ਅਸੀਂ ਸਾਰਾ ਸਮਾਨ ਤਿਆਰ ਕਰਕੇ ਰੇਡੀ ਕਰਕੇ ਰੱਖ ਕੇ ਫੇਰ ਉਸਨੂੰ ਗਰਮ ਹੋਣ ਦੇ ਲਈ ਦੇ ਦਿੰਦੇ ਅਤੇ ਟਾਈਮਰ ਸੈੱਟ ਕਰ ਦਿੰਦੇ ਹਾਂ